ਸਾਡੇ ਖੇਤਰ ਪੰਜਾਬ ਹੁਸ਼ਿਆਰਪੁਰ ਵਿੱਚ ਬਹੁਤ ਕਾਰੋਬਾਰ ਹਨ ਜੋ ਚੰਗੇ ਤਰੀਕੇ ਨਾਲ ਚਲਾਏ ਜਾਣ 'ਤੇ ਵਧੀਆ ਮੁਨਾਫਾ ਕਮਾਇਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਮੁਰਗੀ ਫਾਰਮ ਡੇਰੀ ਫਾਰਮ ਅਤੇ ਹੋਰ ਖੇਤੀਬਾੜੀ ਸਹਾਇਕ ਧੰਦੇ ਚੱਲ ਰਹੇ ਹਨ ਜਿਨ੍ਹਾਂ ਦੀ ਮੰਗ ਬਹੁਤ ਜ਼ਿਆਦਾ ਹੈ ਉਦਾਹਰਣ ਵਜੋਂ ਪੋਲਟਰੀ ਫਾਰਮ ਵਿੱਚ ਲੇਅਰ ਫਾਰਮ ਜੋ ਕਿ ਮੁਰਗੀਆਂ ਤੋਂ ਆਂਡੇ ਵੇਚ ਕੇ ਮੁਨਾਫ਼ਾ ਕਮਾਇਆ ਜਾਂਦਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਸਾਡੇ ਖੇਤਰ ਵਿੱਚ ਚੱਲ ਰਹੇ ਹਨ ਜੋ ਕਿ ਇੱਕ ਲਾਹੇਵੰਦ ਧੰਦੇ ਵਜੋਂ ਜਾਣੇ ਜਾ ਜਾਂਦੇ ਹਨ ਕਿਉਂਕਿ ਸਾਡੇ ਖੇਤਰ ਵਿੱਚ ਐੱਗ ਆਂਡਿਆਂ ਦੀ ਮੰਗ ਬਹੁਤ ਜ਼ਿਆਦਾ ਹੈ ਇਸ ਲਈ ਇਹ ਫਾਰਮ ਬਹੁਤ ਜ਼ਰੂਰੀ ਹਨ